ਮੈਂ ਰਵਾਇਤੀ ਤੌਰ 'ਤੇ ਪੈੱਨ ਕਾਗਜ਼ ਨਾਲ ਲਿਖਣਾ ਪਸੰਦ ਕਰਦੀ ਹਾਂ ਮੈਨੂੰ ਆਪਣੇ ਹੱਥੀਂ ਰੈ ਆਪਣੀ ਲਿਖੀ ਹੋਈ ਰਾਈਟਿੰਗ ਬਹੁਤ ਪਸੰਦ ਹੈ ਮੈਨੂੰ ਲੈਪਟੋਪ ਮੋਬਾਈਲ 'ਤੇ ਟਾਈਪਿੰਗ ਕਰਦੇ ਸਮੇਂ ਮੇਰੀਆਂ ਅੱਖਾਂ ਵਿੱਚ ਦਰਦ ਹੁੰਦਾ ਹੈ ਇਸ ਨਾਲ ਇਸ ਕਰਕੇ ਮੈਨੂੰ ਆਪਣੇ ਹੱਥ ਨਾਲ ਲਿਖਣਾ ਪਸੰਦ ਹੈ ਜੇਕਰ ਮੈਂ ਆਪਣੇ ਹੱਥ ਨਾਲ ਲਿਖਦੀ ਹਾਂ ਤਾਂ ਮੇਰੇ ਸ਼ਬਦ ਸਹੀ ਲਿਖੇ ਜਾਂਦੇ ਹਨ ਔਖੇ ਤੋਂ ਔਖੇ ਸ਼ਬਦ ਮੈਂ ਲਿਖ ਲੈਂਦੀ ਹਾਂ ਅਤੇ ਮੈਨੂੰ ਮੈਂ ਵਧੀਆ ਸ਼ਬਦ ਸਿੱਖ ਸਕਦੀ ਹਾਂ ਇਸ ਨਾਲ ਮੇਰੀ ਲਿਖਣ ਦੀ ਸਪੀਡ ਵੀ ਤੇਜ਼ ਹੁੰਦੀ ਹੈ ਜੇ ਮੈਂ ਇੱਕ ਸਟੂਡੈਂਟ ਹਾਂ ਤਾਂ ਮੈਂ ਆਪਣੇ ਪੇਪਰਾਂ ਦੀ ਤਿਆਰੀ ਕਰਨ ਲਈ ਮੈਂ ਲਿਖ ਮੈਂ ਆਪਣੇ ਹੱਥ ਨਾਲ ਲਿਖਦੀ ਹਾਂ ਅਤੇ ਮੇਰੇ ਪੇਪਰ ਲਿਖਣ ਨਾਲ ਮੇਰੇ ਪੇਪਰ ਦੀ ਸਪੀਡ ਵੀ ਵਧੀਆ ਹੋ ਜਾਂਦੀ ਹੈ ਮੈਂ ਆਪਣਾ ਪੇਪਰ ਅਸਾਨੀ ਨਾਲ ਜਲਦੀ ਤੋਂ ਜਲਦੀ ਖਤਮ ਕਰ ਦਿੰਦੀ ਹਾਂ ਮੋਬਾਈਲ ਚਲਾਉਣ ਨਾਲ ਸਾਡੀਆਂ ਅੱਖਾਂ ਖਰਾਬ ਹੋ ਜਾਂਦੀਆਂ ਹਨ ਇਸ ਲਈ ਮੈਨੂੰ ਆਪਣੇ ਹੱਥ ਨਾਲ ਲਿਖਣਾ ਪਸੰਦ ਹੈ ਬੇਸ਼ੱਕ ਮੈਂ ਪ੍ਰਿੰਟ ਲੈਪਟੋਪ ਤੋਂ ਲੈਂਦੀ ਹਾਂ ਪਰ ਫਿਰ ਵੀ ਮੈਂ ਆਪਣੀ ਰਾਈਟਿੰਗ ਵਿੱਚ ਲਿਖਣਾ ਪਸੰਦ ਕਰਦੀ ਹਾਂ ਮੈਨੂੰ ਆਪਣੀ ਰਾਈਟਿੰਗ ਵਧੀਆ ਲੱਗਦੀ ਹੈ